ਜਨਮ ਹੁੰਦਾ ਹੈ ਤਾਂ ਉਸ ਮੌਕੇ 'ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਬੱਚੇ ਦੇ ਜਨਮ ਸਮੇਂ ਮਾਂ ਪਿਓ ਅਤੇ ਸਾਰੇ ਰਿਸ਼ਤੇਦਾਰਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅਤੇ ਸਾਰੇ ਹੋਸਪਿਟਲ ਵਿੱਚ ਹੀ ਨੱਚਦੇ ਗਾਉਂਦੇ ਘਰ ਤੱਕ ਆਉਂਦੇ ਹਨ ਅਤੇ ਮਠਿਆਈਆਂ ਵੰਡਦੇ ਹਨ ਇੱਥੋਂ ਤੱਕ ਕਿ ਰਿਸ਼ਤੇਦਾਰ ਤਾਂ ਦੂਰ ਦੂਰ ਤੱਕ ਦੇ ਰਿਸ਼ਤੇਦਾਰਾਂ ਨੂੰ ਸੱਦਿਆ ਜਾਂਦਾ ਹੈ ਕਿ ਸਾਡੇ ਮੁੰਡਾ ਹੋਇਆ ਹੈ ਜਾਂ ਸਾਡੇ ਕੁੜੀ ਹੋਈ ਹੈ ਕਿਉਂਕਿ ਅੱਜ ਕੱਲ੍ਹ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਬੱਚੇ ਸਾਰੇ ਇੱਕ ਬਰਾਬਰ ਹੀ ਹੁੰਦੇ ਹਨ ਸੋ ਬੱਚਾ ਕੋਈ ਵੀ ਹੋਵੇ ਬੱਚੇ ਦੇ ਹੋਣ 'ਤੇ ਪੰਜਾਬ ਦੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਹਨ ਅਤੇ ਖੁਸਰਿਆਂ ਨੂੰ ਵੀ ਵੀ ਸੱਦਿਆ ਜਾਂਦਾ ਹੈ ਉਹ ਆ ਕੇ ਤਾਂ ਜੋ ਉਹ ਨੱਚ ਗਾ ਕੇ ਆ ਕੇ ਬੱਚੇ 'ਤੇ ਸਿਰ ਤੋਂ ਆਪਣੀਆਂ ਬੁਲਾਵਾਂ ਲਾ ਕੇ ਉਹਨੂੰ ਦ ਅਸੀਸਾਂ ਦੇ ਕੇ ਜਾਣ ਤਾਂ ਤਾਂ ਜੋ ਬੱਚਾ ਵੱਡਾ ਹੋ ਕੇ ਇੱਕ ਚੰਗਾ ਇਨਸਾਨ ਬਣੇ ਇਹ ਇੱਦਾਂ ਦੀਆਂ ਸਾਰੇ ਰਿਸ਼ਤੇਦਾਰ ਬੱਚਿਆਂ ਨੂੰ ਵਧਾਈਆਂ ਦਿੰਦੇ ਹਨ ਮਾਂ ਪਿਓ ਨੂੰ ਵਧਾਈਆਂ ਮਿਲਦੀਆਂ ਹਨ ਬੱਚੇ ਦੇ ਪਰਿਵਾਰ ਨੂੰ ਵਧਾਈਆਂ ਮਿਲਦੀਆਂ ਹਨ ਅਤੇ ਇਸ ਤਰ੍ਹਾਂ ਬੱਚਾ ਇੱਕ ਖੁਸ਼ੀ ਦੇ ਮਾਹੌਲ ਵਿੱਚ 'ਚ ਪੈਦਾ ਹੁੰਦਾ ਹੈ ਅਤੇ ਪੰਜਾਬ ਵਿੱਚ ਇਹ ਹੁਣ ਹਰ ਇੱਕ ਘਰ ਵਿੱਚ